ਸਮਾਜ ਵਿੱਚ ਡਾਂਸਰਾਂ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਡਾਂਸ ਕਰਨਾ ਚਾਹੁੰਦੇ ਹਨ ਜੋ ਡਾਂਸ ਸਿੱਖਣਾ ਚਾਹੁੰਦੇ ਹਨ ਕਈ ਵਾਰ ਉਨ੍ਹਾਂ ਦੇ ਘਰਦੇ ਇਹ ਇਹ ਗੱਲਾਂ ਦੇ ਖਿਲਾਫ ਹੁੰਦੇ ਹਨ ਪਰ ਉਹ ਆਪਣਾ ਚਾਅ ਪੂਰਾ ਕਰਨਾ ਚਾਹੁੰਦੇ ਹਨ ਡਾਂਸ ਸਿੱਖਣਾ ਚਾਹੁੰਦੇ ਹਨ ਅਤੇ ਕਈ ਮੈਂ ਕਈ ਡਾਂਸਰਾਂ ਨੂੰ ਜਾਣਦੀ ਹਾਂ ਜਿਵੇਂ ਕਿ ਸਪਨਾ ਚੌਧਰੀ ਹੋ ਗਈ ਰਾਖੀ ਸਾਵੰਤ ਹੋ ਗਈ ਸਪਨਾ ਚੌਧਰੀ ਨੂੰ ਬਹੁਤ ਹੀ ਜ਼ਿਆਦਾ ਜਦੋਂ ਉਸਨੇ ਡਾਂਸ ਸ਼ੁਰੂ ਕੀਤਾ ਸਪਨਾ ਚੌਧਰੀ ਨੂੰ ਬਹੁਤ ਜ਼ਿਆਦਾ ਗੰਦੀਆਂ ਗਾ ਗੰਦੀਆਂ ਗੱਲਾਂ ਦਾ ਗੰਦੀਆਂ ਨਜ਼ਰਾਂ ਨਾਲ ਦੇਖਿਆ ਗਿਆ ਗੰਦੀਆਂ ਗੱਲਾਂ ਸੁਣਨੀਆਂ ਪਈਆਂ ਅਤੇ ਬਹੁਤ ਹੀ ਜ਼ਿਆਦਾ ਗੰਦੀਆਂ ਗੱਲਾਂ ਉਸ ਨੂੰ ਕਹੀਆਂ ਗਈਆਂ ਪਰ ਫੇਰ ਵੀ ਉਸ ਨੇ ਆਪਣੇ ਡਾਂਸ ਨੂੰ ਅੱਗੇ ਲਿਆਂਦਾ ਅਤੇ ਆਪਣਾ ਅਤੇ ਆਪਣਾ ਪ੍ਰਸਿੱਧ ਪ੍ਰਸਿੱਧੀ ਹਾਸਲ ਕੀਤੀ ਅਤੇ ਜਦੋਂ ਰਾਖੀ ਸਾਵੰਤ ਦੇ ਮਾਂ ਮਾਤਾ ਪਿਤਾ ਉਸਨੂੰ ਡਾਂਸ 'ਚ ਡਾਂਸਰ ਬਣਨ ਲਈ ਉਸਨੂੰ ਡਾਂਸਰ ਬਣਨ ਨਹੀਂ ਦਿੰਦੇ ਸੀ ਪਰ ਫਿਰ ਵੀ ਉਸਨੇ ਹੱਦ ਤੋਂ ਵੱਧ ਮਿਹਨਤ ਕਰਕੇ ਅਤੇ ਆਪਣੇ ਮਾਪਿਆਂ ਦੇ ਖਿਲਾਫ ਹੋ ਕੇ ਆਪਣਾ ਸੁਪਨਾ ਪੂਰਾ ਕੀਤਾ ਅਤੇ ਉਸ ਡਾਂਸ ਡਾਂਸ ਰਾਹੀਂ ਉਸਨੇ ਆਪ ਨੂੰ ਆਪਣ ਆਪ ਆਪਣੇ ਆਪ ਨੂੰ ਪ੍ਰਸਿੱਧੀ ਹਾਸਲ ਕਰਵਾਈ ਅਤੇ ਅੱਜ ਉਹ ਬਹੁਤ ਹੀ ਵਧੀਆ ਡਾਂਸ ਬਹੁਤ ਹੀ ਵਧੀਆ ਜ਼ਿੰਦਗੀ ਜੀ ਰਹੀ ਹੈ ਅਤੇ ਸਪਨਾ ਚੌਧਰੀ ਵੀ ਹੁਣ ਆਪਣੀ ਜਿ ਖੁਸ਼ਹਾਲ ਜ਼ਿੰਦਗੀ ਜੀ ਰਹੀ ਅਤੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ ਤਾਂ ਡਾਂਸਰ ਕਈ ਵਾਰੀ ਬਹੁਤ ਹੀ ਜ਼ਿਆਦਾ ਬੁਰੀ ਸਮੱਸਿਆ ਤੋਂ ਖ ਗੁਜ਼ਰਦੇ ਹਨ ਜੋ ਆਪਾਂ ਨੂੰ ਨਹੀਂ ਪਤਾ ਅਤੇ ਉਸ ਨੂੰ ਬਹੁਤ ਜ਼ਿਆਦਾ ਗੱਲਾਂ ਅਤੇ ਕੋਈ ਮੁਸ਼ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿੱਦਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਅਤੇ ਜੋ ਆਪਾਂ ਨੂੰ ਨਹੀਂ ਪਤਾ